ਹਾਂ ਅਸੀਂ ਮੰਨਦੇ ਹਾਂ ਕਿ ਬਹੁਤ ਜ਼ਿਆਦਾ ਸਕਰੀਨ ਦੇਖਣ ਨਾਲ਼ ਬੱਚੇ ਅੱਜ ਕੱਲ੍ਹ ਗੇਮਾਂ ਨਹੀਂ ਖੇਡਦੇ ਜਿਸ ਕਰਕੇ ਉਹਨਾਂ ਨੂੰ ਉਹਨਾਂ ਦੀ ਮਾਨਸਿਕਤਾ ਵਿੱਚ ਕਮੀ ਆਉਂਦੀ ਅਤੇ ਉਹਨਾਂ ਦੀ ਅੱਖਾਂ ਵਿੱਚ ਪ੍ਰੋਬਲਮ ਹੁੰਦੇ ਨੇ ਪੂਰੇ ਦਿਨ ਬੱਚੇ ਸਕੂਲ ਤੋਂ ਆ ਕੇ ਇੰਸਟਾਗ੍ਰਾਮ ਯੂਟਿਊਬ ਫੇਸਬੁੱਕ ਆਦਿ ਚੀਜ਼ਾਂ ਅਤੇ ਆਪਣੇ ਸਮਾਂ ਨੂੰ ਖ਼ਰਾਬ ਕਰਦੇ ਨੇ ਜਿਸ ਕਰਕੇ ਉਹਨਾਂ ਦੇ ਸਮਾਂ ਦੇ ਨਾਲ਼ ਨਾਲ਼ ਉਹਨਾਂ ਦੇ ਅੱਖਾਂ ਵਿੱਚ ਵੀ ਪ੍ਰੋਬਲਮ ਹੁੰਦਾ ਅਤੇ ਉਹਨਾਂ ਦੇ ਮਨ ਸ਼ਰੀਰ ਵਿੱਚ ਵੀ ਪ੍ਰੋਬਲਮ ਹੁੰਦਾ ਉਹ ਇੱਕ ਜਗ੍ਹਾ ਬੈਠ ਕੇ ਹੀ ਪੂਰੇ ਦਿਨ ਫ਼ੋਨ ਨੂੰ ਯੂਜ਼ ਕਰਦੇ ਰਹਿੰਦੇ ਨੇ ਫਿਜ਼ੀਕਲ ਗੇਮ ਖੇਡਣ ਨਾਲ਼ ਸਾਨੂੰ ਤੰਦਰੁਸਤੀ ਵੀ ਮਿਲਦੀ ਹੈ ਅਤੇ ਉਹ ਨਾਲ਼ ਦਿਮਾਗ਼ ਵੀ ਫਰੈਸ਼ ਰਹਿੰਦਾ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਫਿਜ਼ੀਕਲ ਖੇਡਾਂ ਬਹੁਤ ਜ਼ਰੂਰੀ ਹੁੰਦੀ ਨੇ ਸ਼ਰੀਰ ਦੇ ਲਈ ਇਸ ਕਰਕੇ ਸਾਨੂੰ ਫਿਜ਼ੀਕਲ ਖੇਡਾਂ ਹੀ ਖੇਡਣੀ ਚਾਹੀਦਾ ਹੈ ਅਤੇ ਫ਼ੋਨ ਨੂੰ ਜ਼ਿਆਦਾ ਸੇ ਜ਼ਿਆਦਾ ਦੂਰ ਰੱਖਨਾ ਚਾਹੀਦਾ ਹੈ